ਮੈਂ ਅੰਸ਼ੁਲ ਮੈਂ ਪਠਾਨਕੋਟ ਦਾ ਰਹਿਣ ਵਾਲਾ ਹਾਂ ਅਤੇ ਮੈਂ ਇਹ ਗੱਲ ਸੋਚਦਾ ਹਾਂ ਕਿ ਬੱਚਿਆਂ ਨੂੰ ਪੰਜਾਬੀ ਭਾਸ਼ਾ ਸਿਖਾਉਣਾ ਬਹੁਤ ਮਹੱਤਵਪੂਰਨ ਹੈ ਕਿਉਂਕਿ ਅਸੀਂ ਅੱਜ ਕੱਲ੍ਹ ਵੇਖਦੇ ਹਾਂ ਕਿ ਸਾਡੇ ਪੰਜਾਬ ਦੇ ਬੱਚੇ ਆਪਣੇ ਸੱਭਿਆਚਾਰ ਤੋਂ ਬਹੁਤ ਦੂਰ ਜਾ ਰਹੇ ਹਨ

ਅਸੀਂ ਇਹ ਵੀ ਦੇਖਦੇ ਹਾਂ ਕਿ ਜਿਵੇਂ ਕਿ ਅੱਜ ਦੀਆਂ ਸਰਕਾਰਾਂ ਨੇ ਪੰਜਾਬੀ ਭਾਸ਼ਾ ਨੂੰ ਲਾਜ਼ਮੀ ਕਰ ਦਿੱਤਾ ਹੈ ਅਤੇ ਇਸ ਕਰਕੇ ਵੀ ਪੰਜਾਬ 'ਚ ਰਹਿਣ ਵਾਲੇ ਨੂੰ ਤਾਂ ਪੰਜਾਬੀ ਸਿੱਖਣੀ ਚਾਹੀਦੀ ਹੈ ਤਾਂ ਕਿ ਉਹ ਚੰਗੀ ਤਰ੍ਹਾਂ ਪੰਜਾਬੀ ਬੋਲ ਸਕੇ ਤੇ ਅਤੇ ਪੜ੍ਹ ਵੀ ਸਕੇ ਅਤੇ ਇਸ ਕਰਕੇ ਸਾਨੂੰ ਸਾਰਿਆਂ ਨੂੰ ਬੱਚਿਆਂ ਨੂੰ ਤਾਂ ਪੰਜਾਬੀ ਸਿਖਾਉਣੀ ਹੀ ਚਾਹੀਦੀ ਹੈ ਕਿਉਂਕਿ ਇਸ ਨਾਲ ਇੱਕ ਤਾਂ ਉਹ ਆਪਣੇ ਮ ਆਪਣੇ ਸੱਭਿਆਚਾਰਕ ਨਾਲ ਜੁੜੇ ਰਹਿਣਗੇ ਅਤੇ ਉਸ ਤੋਂ ਇਲਾਵਾ ਉਹ ਇਹ ਅਪ ਜੋ ਉਹਨਾਂ ਨੇ ਸਿੱਖਿਆ ਪੰਜਾਬੀ ਵਿੱਚ ਉਹ ਹੋਰਾਂ ਨੂੰ ਵੀ ਸਿਖਾਉਣਗੇ ਅਤੇ ਜਿਸ ਦੇ ਨਾਲ ਉਹ ਹਰ ਹਰ ਕਿਸਮ ਅਤੇ ਹਰ ਕਿਸਮ ਦੀ ਪੰਜਾਬੀ ਪੜ੍ਹ ਸਕਦੇ ਨੇ ਅਤੇ ਲਿਖ ਵੀ ਸਕਦੇ ਨੇ ਅਤੇ ਬੱਚਿਆਂ ਨੂੰ ਪੰਜਾਬੀ ਸਿੱਖਣ ਨਾਲ ਉਹਨਾਂ ਦਾ ਇੱਕ ਤਾਂ ਬੋਲਣ ਦਾ ਢੰਗ ਬਦਲੇਗਾ ਅਤੇ ਇੱਕ ਤਾਂ ਉਹ ਆਪਣੇ ਮਾਤਰ ਭਾਸ਼ਾ ਸਿੱਖਣਗੇ ਅਤੇ ਉਹਨਾਂ ਨੂੰ ਇਸ ਕਰਕੇ ਸਿਖਾਉਣੀ ਚਾਹੀਦੀ ਹੈ ਕਿ ਇੱਕ ਤਾਂ ਉਹ ਪੰਜਾਬ 'ਚ ਰਹਿੰਦੇ ਨੇ ਅਤੇ ਜਿੱਥੋਂ ਦੇ ਉਹ ਜੰਮ ਪਲ ਨੇ ਉਹਨਾਂ ਨੂੰ ਉਹ ਮਾਤਰ ਭਾਸ਼ਾ ਤਾਂ ਆਉਣੀ ਚਾਹੀਦੀ ਹੈ ਤਾਂ ਮੇਰੇ ਹਿਸਾਬ ਨਾਲ ਤਾਂ ਪੰਜਾਬ 'ਚ ਰਹਿਣ ਵਾਲੇ ਨੂੰ ਤਾਂ ਪੰ ਪੰਜਾਬੀ ਬੋਲਣੀ ਲਿਖਣਾ ਅਤੇ ਇਹ ਆਉਣਾ ਚਾਹੀਦਾ ਅਤੇ ਬਾਕੀ ਜਿਵੇਂ ਕਿ ਅਸੀਂ ਦੇਖਦੇ ਹਾਂ ਸਕੂਲਾਂ ਵਿੱਚ ਵੀ ਪੰਜਾਬੀ ਨੂੰ ਹੁਣ ਬਹੁਤ ਮਹੱਤਵ ਮਹੱਤਵਤਾ ਦਿੱਤੀ ਜਾ ਰਹੀ ਹੈ ਇਹ ਬਹੁਤ ਹੀ ਚੰਗਾ ਕਦਮ ਹੈ ਸਰਕਾਰ ਵੱਲੋਂ ਕਿ ਜੋ ਸਾਡੇ ਬੱਚੇ ਸਕੂਲ ਵਿੱਚ ਪੜ੍ਹਦੇ ਨੇ ਉਹਨਾਂ ਨੂੰ ਪੰਜਾਬੀ ਸਿਖਾਈ ਜਾ ਰਹੀ ਹੈ ਪੜ੍ਹਾਈ ਜਾ ਰਹੀ ਹੈ ਅਤੇ ਲਿਖਾਈ ਵੀ ਜਾ ਰਹੀ ਹੈ ਜਿਸ ਨਾਲ ਉਹ ਪੰਜਾਬੀ ਬਹੁਤ ਹੀ ਸਹੀ ਢੰਗ ਨਾਲ ਬੋਲ ਲੈਂਦੇ ਨੇ ਅਤੇ ਪੰਜਾਬੀ ਇੱਕ ਬਹੁਤ ਹੀ ਚੰਗੀ ਭਾਸ਼ਾ ਹੈ ਮੇਰੇ ਹਿਸਾਬ ਨਾਲ ਬਾਕੀ ਭਾਸ਼ਾਵਾਂ ਤਾਂ ਬੱਚਿਆਂ ਨੂੰ ਸਿਖਾਉਣੀ ਚਾਹੀਦੀ ਹੈ ਉਸ ਦੇ ਨਾਲ ਨਾਲ ਪੰਜਾਬੀ ਭਾਸ਼ਾ ਤਾਂ ਵੀ ਜ਼ਰੂਰ ਜ਼ੋਰ ਦੇਣਾ ਚਾਹੀਦਾ ਕਿ ਉਹਨਾਂ ਨੂੰ ਪੰਜਾਬ ਚ ਰਹਿ ਕੇ ਨਾ ਪੰਜਾਬੀ ਤਾਂ ਆਉਣੀ ਚਾਹੀਦੀ ਹੈ ਧੰਨਵਾਦ